ਰਿਟਾਇਡ ਅਟੇ ਅਤੇ ਬਜ਼ੁਰਗ ਜਿਵੇਂ ਕਿ ਪਹਿਲਾਂ ਹੁੰਦਾ ਸੀਗਾ ਕਿ ਬੰਦਾ ਰਿਟਾਇਡ ਹੋ ਗਿਆ ਅਤੇ ਬਜ਼ੁਰਗ ਸੀਗੇ ਉਹ ਆਪਣਾ ਬੈਠੇ ਰਹਿੰਦੇ ਸੀਗੇ ਅਤੇ ਓਸ ਟਾਈਮ ਬੰਦੇ ਦੇ ਸਰੀਰਕ ਗਤੀਵਿਧੀ ਕਰਨ ਦੀ ਹ ਹਲਾਤ ਨਹੀਂ ਹੁੰਦੇ ਉਹ ਬਹੁਤਾ ਨਹੀਂ ਚਲ ਫਿਰ ਸਕਦਾ ਉਹਨੇ ਘਰ ਬੈਠਣਾ ਹੁੰਦਾ ਹੈਗਾ ਅਤੇ ਉਹ ਫੇਰ ਟੀਵੀ ਅਤੇ ਇੰਟਰਨੈੱਟ ਉਨ੍ਹਾਂ ਦੀ ਕਾਫ਼ੀ ਸਹੂਲਤ ਹੁੰਦੀ ਹੈ ਅਤੇ ਉਹ ਕਾਫ਼ੀ ਜ਼ਿਆਦਾ ਆਪਣਾ ਟੀਵੀ ਦੇਖ ਕੇ ਆਪਣਾ ਟੈਮ ਲੰਘਾਉਂਦੇ ਹੈ ਅਤੇ ਜਿਵੇਂ ਬਜ਼ੁਰਗਾਂ ਦੇ ਬੱਚੇ ਜਿਵੇਂ ਬਾਹਰ ਰਹਿੰਦੇ ਹੁੰਦੇ ਹੈ ਅਤੇ ਉਹ ਪਹਿਲਾਂ ਬੜਾ ਤੜਫਦੇ ਰਹਿੰਦੇ ਸੀਗੇ ਕਿ ਅਸੀਂ ਉਨ੍ਹਾਂ ਨਾਲ ਗੱਲ ਕਰਨੀ ਹੈ ਅਤੇ ਜਿਵੇਂ ਜਦ ਤੋਂ ਇੰਟਰਨੈੱਟ ਜਾਂ ਟੈਕਨੋਲਜੀ ਆਈ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਇਹ ਕਾਫ਼ੀ ਹਾਨੀ ਹੋਗੀ ਉਹ ਬੱਚਿਆਂ ਨਾਲ ਗੱਲ ਕਰ ਸਕਦੇ ਹੈ ਆਰਾਮ ਨਾਲ ਫੋਨ 'ਤੇ ਵੀਡੀਓ ਕੌਲ ਕਰ ਲੈਂਦੇ ਹੈ ਇਹ ਇੰਟਰਨੈੱਟ ਦੇ ਟੀਵੀ ਨੇ ਫੋਨਾਂ ਨੇ ਬੜਾ ਹੀ ਜ਼ਿਆਦਾ ਸੌਖਾ ਕਰਤਾ ਦਿੱਤਾ ਬਜ਼ੁਰਗਾਂ ਲਈ ਅਤੇ ਉਨ੍ਹਾਂ ਦੀ ਜਿਵੇਂ ਉਹ ਪਹਿਲਾਂ ਤੜਫਦੇ ਰਹਿੰਦੇ ਸੀਗੇ ਹੁਣ ਉਹ ਆਪਣੇ ਬੱਚਿਆਂ ਨਾਲ ਕਦੇ ਵੀ ਕਿਸੇ ਵੀ ਟਾਈਮ ਗੱਲ ਕਰ ਲੈਂਦੇ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ 'ਚ ਕਾਫ਼ੀ ਜ਼ਿਆਦਾ ਬਦਲਾਅ ਆਇਆ ਇਸ ਚੀਜ਼ ਨਾਲ ਉਨ ਦੇਸ਼ ਦੁਨੀਆਂ ਨਾਲ ਜੁੜੇ ਰਹਿੰਦੇ ਹੈ ਟੀਵੀ ਦੇ ਮਾਧਿਅਮ ਤੋਂ ਅਤੇ ਫੋਨ ਦੇ ਮਾਧਿਅਮ ਤੋਂ ਉਹ ਕਾਫ਼ੀ ਕੁਛ ਉਨ੍ਹਾਂ ਨੂੰ ਪਤਾ ਲੱਗਦਾ ਰਹਿੰਦਾ ਹੈਗਾ ਘਰ ਬੈਠਿਆਂ ਨੂੰ ਵੀ ਅਤੇ ਅਤੇ ਪਹਿਲਾਂ ਜਿਵੇਂ ਉਨ ਇਕੱਲੇ ਬੈਠੇ ਉਨ੍ਹਾਂ ਨੂੰ ਕੋਈ ਨਾ ਕੋਈ ਨਾਲ ਨੂੰ ਬੰਦਾ ਚਾਹੀਦਾ ਹੁੰਦਾ ਸੀ ਗੱਲਾਂ ਗੁੱਲਾਂ ਕਰਨ ਲਈ ਹੁਣ ਟੀਵੀ 'ਤੇ ਇੰਨੇ ਟੈਕਨੋਲਜੀ ਨੇ ਕਾਫ਼ੀ ਜ਼ਿਆਦਾ ਉਨ੍ਹਾਂ ਦਾ ਇਸ ਚੀਜ਼ ਮਦਦ ਕੀਤੀ ਹੈ ਅਤੇ ਉਹ ਆਪਣਾ ਬੈਠ ਕੇ ਗੱਲ ਗੁੱਲ ਆਪਣਾ ਟੀਵੀ 'ਤੇ ਦੇਖਦੇ ਰਹਿੰਦੇ ਹੈ ਸਾਰੀਆਂ ਖਬਰਾਂ ਮੈਚ ਸਾਰਾ ਕੁਛ ਆਉਂਦਾ ਰਹਿੰਦਾ ਹੈ